ਮੈਂ ਪੰਜਾਬ ਰਾਜ ਦੀ ਰਹਿਣ ਵਾਲੀ ਹਾਂ ਮਾਝਾ ਖੇਤਰ ਵਿੱਚ ਰਹਿੰਦੀ ਹਾਂ ਮਾਝਾ ਖੇਤਰ ਵਿੱਚ ਮਾਝਾ ਬੋਲੀ ਜਿਹੜੀ ਆਪਾਂ ਬੋਲਦੇ ਹਾਂ ਉਹਨੂੰ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ ਮਾਝਾ ਮਾਲਵਾ ਹੋਰ ਆਪਣੀਆਂ ਬਹੁਤ ਪੰਜਾਬੀ ਬੋਲੀਆਂ ਨੇ ਮਾਝਾ ਮਾਲਵਾ ਦੁਆਬਾ ਇਹਨਾਂ ਖੇਤਰਾਂ ਵਿੱਚ ਵੱਖ ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਜਿੱਦਾਂ ਮਾਝੇ ਵਿੱਚ ਮਾਲਵੀ ਬੋਲਿਆ ਜਾਂਦਾ ਮਾਲਵੀ ਬੋਲੀ ਜਾਂਦੀ ਹੈ ਮ ਮਾਝੇ ਵਿੱਚ ਮਾਝੀ ਬੋਲੀ ਬੋਲੀ ਜਾਂਦੀ ਆ ਮਾਲਵੇ 'ਚ ਮਾਲਵੀ ਦੁਆਬਾ ਵਿੱਚ ਦੁਆਬੀ ਭਾਸ਼ਾ ਬੋਲੀ ਜਾਂਦੀ ਆ ਜਿਸ ਤਰ੍ਹਾਂ ਹੁਣ ਪੋਠੋਹਾਰੀ ਭਾਸ਼ਾ ਵੀ ਹੈ ਆਪਣੇ ਉਹਦੇ ਵੱਖਰੇ ਖੇਤਰ ਵਿੱਚ ਇਹ ਸਾਰੀਆਂ ਭਾਸ਼ਾਵਾਂ ਜਿਹੜੀਆਂ ਨੇ ਇਹ ਪੰਜਾਬੀ ਭਾਸ਼ਾ ਦਾ ਹੀ ਰੂਪ ਹਨ ਟਕਸਾਲੀ ਭਾਸ਼ਾ ਵੀ ਇਹਨੂੰ ਮਾਝੇ ਦੀ ਬੋਲੀ ਨੂੰ ਹੀ ਟਕਸਾਲੀ ਭਾਸ਼ਾ ਕਿਹਾ ਜਾਂਦਾ ਹੈ ਜਿੱਦਾਂ ਹੁਣ ਕੋਈ ਸਾਡੇ ਸਰਕਾਰੀ ਕੰਮ ਹੋਵੇ ਸਰਕਾਰੀ ਕੰਮ ਕਰਨਾ ਕਰਾਉਂਦੇ ਹਾਂ ਕਰਦੇ ਹਾਂ ਸਰਕਾਰੀ ਕੰਮਾਂ ਦੇ ਵਿੱਚ ਟਕਸਾਲੀ ਭਾਸ਼ਾ ਜਿੱਦਾਂ ਮਾਝਾ ਬੋਲੀ ਜਿਹੜੀ ਆ ਉਹ ਬੋਲੀ ਜਾਂਦੀ ਆ ਮੈਨੂੰ ਹੋਰ ਵੀ ਬਹੁਤ ਸਾਰੀਆਂ ਭਾਸ਼ਾਵਾਂ ਮੈਨੂੰ ਮਾਝਾ ਬੋਲੀ ਜਿਹੜੀ ਆ ਮੈਂ ਬੋਲ ਸਕਦੀ ਹਾਂ ਕਿਉਂਕਿ ਮੈਂ ਮਾਝੇ ਵਿੱਚ ਰਹਿੰਦੀ ਹਾਂ ਉਹ ਮਾਝੇ ਟਕਸਾਲੀ ਭਾਸ਼ਾ ਜਿਹੜੀ ਆ ਉਹਨੂੰ ਬੋਲ ਸਕਦੀ ਹਾਂ ਉਹ ਖੇਤਰ ਵਿੱਚ ਰਹਿੰਦੀ ਹਾਂ ਹੋਰ ਵੀ ਜਿਸ ਤਰ੍ਹਾਂ ਹੁਣ ਹੋਰ ਵੀ ਬੋਲੀਆਂ ਨੇ ਪੋਠੋਹਾਰੀ ਬੋਲੀ ਆ ਭਾਸ਼ਾ ਜਿਹੜੀ ਆ ਉਹ ਜ਼ਿਆਦਾਤਰ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ ਕਿਉਂਕਿ ਜਦੋਂ ਸਾਡੀ ਦੇਸ਼ ਦੀ ਵੰਡ ਹੋਈ ਸੀਗੀ ਉਦੋਂ ਸਾਡੇ ਕੁਛ ਲੋਕ ਵੰਡੇ ਗਏ ਕੋਈ ਪਾਕਿਸਤਾਨ ਵਿੱਚ ਚਲੇ ਗਏ ਕੁਛ ਇੱਧਰ ਰਹਿ ਗਏ ਸੀਗੇ ਪੰਜਾਬ ਵਿੱਚ ਉਹ ਜਿਹੜੀ ਪੋਠੋਹਾਰੀ ਬੋਲੀ ਆ ਉਹ ਜ਼ਿਆਦਾਤਰ ਪਾਕਿਸਤਾਨ ਵਿੱਚ ਹੀ ਬੋਲੀ ਜਾਂਦੀ ਆ ਔਰ ਜਿਸ ਤਰ੍ਹਾਂ ਹੁਣ ਆਪਾਂ ਗੱਲ ਕਰ ਲਈਏ ਮਾਲਵੇ ਦੀ ਮਾਲਵੇ ਵਿੱਚ ਜਿਹੜੀ ਆ ਮਲਵਈ ਬੋਲੀ ਜਿਹੜੀ ਉੱਥੇ ਹੋਰ ਬੋਲਿਆ ਜਾਂਦਾ ਜਿੱਦਾਂ ਇਹ ਬਾਲਟਾ ਕਹਿੰਦੇ ਉਹ ਹੰਡਾ ਕਹਿੰਦੇ ਆ ਇੱਦਾਂ ਕਰਕੇ ਬਹੁਤ ਸਾਰਾ ਫ਼ਰਕ ਪੈ ਜਾਂਦਾ ਬੋਲੀ ਵਿੱਚ ਤਾਂ ਵੱਖੋ ਵੱਖਰੀਆਂ ਭਾਸ਼ਾਵਾਂ ਨੇ